ਪੜ੍ਹਨ ਲਿਖਣ ਦਾ ਮੈਨੂੰ ਖਾਸਾ ਸ਼ੌਂਕ ਹੈ ਜਾਣੀ ਕਿ ਮੈਂ ਕਿਤਾਬਾਂ ਕਤੂਬਾਂ ਵੀ ਸੋਹਣੀਆਂ ਰੱਖੀਆਂ ਵੀ ਹੈਂ ਅਤੇ ਜਾਣੀ ਕਿ ਸਭ ਤੇ ਜੇ ਮਨਪਸੰਦ ਕਿਤਾਬ ਦੀ ਗੱਲ ਕਰੀ ਜਾਵੇ ਤਾਂ ਮੇਰੀ ਮਨਪਸੰਦ ਕਿਤਾਬ ਰਿੱਚ ਡੈਡ ਪੂਅਰ ਡੈਡ ਹੈ ਰੌਬਰਟ ਕਿਯੋਸਾਕੀ ਦੀ ਜਾਣੀ ਕਿ ਇਹ ਕਿਤਾਬ ਨੂੰ ਪੜ੍ਹ ਕੇ ਕਾਫ਼ੀ ਜਾਣਕਾਰੀ ਮਿਲਦੀ ਹੈ ਵੀ ਕਿਵੇਂ ਪੈਸਾ ਚੱਲਦਾ ਹੈ ਅਤੇ ਕਿਵੇਂ ਪੈਸੇ ਨੂੰ ਖਰਚਣਾ ਹੈ ਸਭ ਤੋਂ ਮੇਨ ਚੀਜ਼ ਪੈਸੇ ਦਾ ਖਰਚਣਾ ਹੁੰਦਾ ਹੈ ਵੀ ਪੈਸਾ ਤੁਸੀਂ ਸਹੀ ਖਰਚ ਪਾਉਂਦੇ ਜਾਂ ਨਹੀਂ ਪਾਉਂਦੇ ਜੇ ਤੁਸੀਂ ਪੈਸਾ ਸਹੀ ਜਗ੍ਹਾ ਖਰਚ ਰਹੇ ਹੋ ਮੰਨ ਲਉ ਆਪਾਂ ਪੈਸਾ ਇਹੋ ਜਿਹੀ ਜਗ੍ਹਾ ਖਰਚ ਦਿੱਤਾ ਜਿੱਥੋਂ ਆਪਾਂ ਨੂੰ ਦੁਬਾਰਾ ਪੈਸਾ ਬਣਨਾ ਹੈ ਉਹ ਚੰਗੀ ਜਗ੍ਹਾ ਖਰਚਿਆ ਹੈ ਹੁਣ ਜਿੱਥੇ ਆਪਾਂ ਪੈਸਾ ਇਹੋ ਜਿਹੀ ਜਗ੍ਹਾ ਖਰਚ ਦਿੱਤਾ ਵੀ ਉੱਥੇ ਦੁਬਾਰਾ ਲਾਉਣੇ ਪੈਣੇ ਹੋਰ ਪੈਸੇ ਫੇਰ ਉਹ ਜਾਣੀ ਕਿ ਆਪਣਾ ਮਾੜਾ ਖਰਚਾ ਹੈ ਇਹੋ ਜਿਹੀਆਂ ਚੀਜ਼ਾਂ ਜਾਣੀ ਕਿ ਮੈਨੂੰ ਉਹਨੂੰ ਉਹ ਕਿਤਾਬ 'ਚੋਂ ਸਿੱਖਣ ਨੂੰ ਮਿਲੀਆਂ ਅਸਲ ਦੇ ਵਿੱਚ ਹੋਇਆ ਇੱਦਾਂ ਕਿ ਪਟਿਆਲੇ ਲੱਗਿਆ ਹੋਇਆ ਸੀ ਬੁੱਕ ਫੇਅਰ ਅਤੇ ਅਸੀਂ ਕੋਲੇਜ ਵਾਲਿਆਂ ਨਾਲ ਗੱਲ ਕੀਤੀ ਵੀ ਸਾਨੂੰ ਵੀ ਲੈ ਕੇ ਚੱਲੋ ਉੱਥੇ ਅਤੇ ਚਲੋ ਅਸੀਂ ਮਨਾ ਲਏ ਕੋਲੇਜ ਵਾਲੇ ਅਤੇ ਫਿਰ ਸਾਨੂੰ ਲੈ ਕੇ ਗਏ ਉੱਥੇ ਬੁੱਕ ਫੇਅਰ 'ਚ ਉੱਥੇ ਜਾਣੀ ਕਿ ਸੁਣਿਆ ਕਾਫ਼ੀ ਸੀ ਇਹ ਬੁੱਕ ਬਾਰੇ ਅਤੇ ਫਿਰ ਉੱਥੇ ਪਈ ਦੇਖ ਕੇ ਮੈਂ ਕਿਹਾ ਚੱਲ ਚੱਕ ਹੀ ਲਈਏ ਅਤੇ ਕਿਤਾਬ ਉੱਦਾਂ ਹੀ ਚੱਕ ਲਿਆਂਦੀ ਕਿਤਾਬਾਂ ਹੋਰ ਵੀ ਦੋ ਤਿੰਨ ਲਿਆਉਂਦੀਆਂ ਸੀ ਮੈਂ ਬਟ ਉਹਨਾਂ 'ਚੋਂ ਇਹ ਕਿਤਾਬ ਬਹੁਤ ਵਧੀਆ ਰਹੀ ਜਾਣੀ ਕਿ ਇੱਕ ਤਰੀਕੇ ਨਾਲ਼ ਕਹਿ ਦਈਏ ਤਾਂ ਮੇਰੀ ਮਨਪਸੰਦ ਕਿਤਾਬ ਰਹੀ ਅੱਜ ਤੱਕ ਦੀ ਇਹ